ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸੰਦੀਪ ਕੌਰ ਹੈ ਮੈਂ ਤੁਹਾਡੀ ਵੈੱਬਸਾਈਟ ਤੋਂ ਮੈਂ ਇੱਕ ਪ੍ਰੈੱਸ ਖ਼ਰੀਦੀ ਸੀ ਜਿਸਦਾ ਕਿ ਮੈਂ ਰਿਵਿਊ ਦੇ ਰਹੀ ਹਾਂ ਉਹ ਬਹੁਤ ਹੀ ਵਧੀਆ ਪ੍ਰੈੱਸ ਹੈ ਤੁਹਾਡਾ ਬੰਦਾ ਜਿਵੇਂ ਕਿਹਾ ਸੀ ਤੁਸੀਂ ਕਿ ਆ ਕੇ ਉਹਨੂੰ ਚਲਾ ਕੇ ਜਾਵੇਗਾ ਅਤੇ ਮੈਂ ਕੈਸ਼ ਔਨ ਡਿਲੀਵਰੀ ਕੀਤੀ ਸੀਗੀ ਜਿਸ ਕਰਕੇ ਮੈਂ ਉਹਦੀਆਂ ਸਾਰੀ ਫੀਚਰਸ ਤੋਂ ਜੋ ਵੀ ਤੁਸੀਂ ਦੱਸੀਆਂ ਸੀਗੀਆਂ ਉਹ ਬਿਲਕੁਲ ਉੱਦਾਂ ਹੀ ਹੈ ਪ੍ਰੈੱਸ ਵਿੱਚ ਉਹ ਮੈਨੂੰ ਵਰਤਣ ਵਿੱਚ ਬਹੁਤ ਵਧੀਆ ਲੱਗਦੀ ਹੈ ਜਿਸ ਨਾਲ ਕਿ ਮੈਂ ਬਿਲਕੁਲ ਸੰਤੁਸ਼ਟ ਹਾਂ ਸਗੋਂ ਮੇਰੇ ਆਂਢ ਗੁਵਾਂਢੀ ਵੀ ਇੰਨੀ ਘੱਟ ਕੀਮਤ ਵਿੱਚ ਪ੍ਰੈੱਸ ਨੂੰ ਦੇਖ ਕੇ ਬਹੁਤ ਹੈਰਾਨ ਹੋਏ ਅਤੇ ਮੈਨੂੰ ਪੁੱਛ ਰਹੇ ਸੀ ਅਤੇ ਮੈਂ ਉਹਨਾਂ ਨੂੰ ਤੁਹਾਡੀ ਵੈੱਬਸਾਈਟ ਦਾ ਵੇਰਵਾ ਦਿੱਤਾ ਅਤੇ ਸ਼ਾਇਦ ਉਹ ਵੀ ਅੱਗੇ ਫਿਊ ਭਵਿੱਖ ਵਿੱਚ ਤੁਹਾਡੀ ਵੈੱਬਸਾਈਟ ਤੋਂ ਸ਼ੋਪਿੰਗ ਕਰਨਗੇ